ਉੱਨੀ ਫਰਵਰੀ ਉੱਨੀ ਸੌ ਅਠਾਸੀ ਬਾਈ ਨਵੰਬਰ ਉੱਨੀ ਸੌ ਉਣਾਨਵੇਂ ਅਠਾਰਾਂ ਅਕਤੂਬਰ ਉੱਨੀ ਸੌ ਤਰਾਨਵੇਂ ਅੱਠ ਅਕਤੂਬਰ ਦੋ ਹਜ਼ਾਰ ਦਸ ਪੱਚੀ ਨਵੰਬਰ ਦੋ ਹਜ਼ਾਰ ਇੱਕੀ